ਪੰਜਾਬ ਦੇ ਸਮਾਜਿਕ ਆਰਥਿਕ ਅਤੇ ਸਭਿਆਚਾਰਕ ਵਿਕਾਸ ਵਿੱਚ ਔਰਤਾਂ ਦੀ ਭੂਮਿਕਾ ਇਤਿਹਾਸਿਕ ਅਤੇ ਸਮਕਾਲੀ ਦੋਨੋਂ ਸਮਿਆਂ ਵਿੱਚ ਮਹੱਤਵਪੂਰਨ ਰਹੀ ਹੈ ਔਰਤਾਂ ਨੇ ਆਪਣੇ ਅਦਾਨ ਪ੍ਰਦਾਨ ਸਮਰਥਨ ਅਤੇ ਪ੍ਰਬੰਧਨ ਦੇ ਰੂਪ ਔਰਤਾਂ ਨੇ ਆਪਣੇ ਅਦਾਨ ਪ੍ਰਦਾਨ ਸਮਰਥਨ ਅਤੇ ਪ੍ਰਬੰਧਨ ਦੇ ਰੂਪ ਵਿੱਚ ਵਿਲੱਖਣ ਯੋਗਦਾਨ ਪਾਇਆ ਹੈ ਜਿਸ ਦੇ ਤੱਤ ਇਸ ਪ੍ਰਕਾਰ ਹਨ ਇਤਿਹਾਸਿਕ ਸਮੇਂ ਵਿੱਚ ਔਰਤਾਂ ਦੀ ਭੂਮਿਕਾ ਸਮਾਜਿਕ ਸਥਿਤੀ ਪੁਰਾਣੀ ਸਮਿਆਂ ਵਿੱਚ ਸਮਾਜਿਕ ਸਥਿਤੀ ਪੁਰਾਣੇ ਸਮਿਆਂ ਵਿੱਚ ਪੰਜਾਬ ਦੀਆਂ ਔਰਤਾਂ ਨੇ ਘਰੇਲੂ ਜੀਵਨ ਪਰਿਵਾਰਕ ਚਰਿਆ ਅਤੇ ਅਤੇ ਜੜੀ ਬੂਟੀ ਦੇ ਕਾਰਜਾਂ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਉਹਨਾਂ ਨੇ ਸੰਸਾਰਕ ਪ੍ਰੀਤੀ ਰਿਵਾ ਤੇਤੀ ਰਿਵਾਜਾਂ ਅਤੇ ਪਰੰਪਰਾਵਾਂ ਨੂੰ ਬਚਾਏ ਰੱਖਣ ਵਿੱਚ ਸਹਾਇਤਾ ਕੀਤੀ ਕਿਤਾਬ ਕਿਤਾਬਾਂ ਅਤੇ ਸਿੱਖਿਆ ਸਿੱਖ ਧਰਮ ਦੇ ਨਾਲ ਸੰਬੰਧਿਤ ਔਰਤਾਂ ਨੇ ਵਿਸ਼ੇਸ਼ ਕਰਕੇ ਗੁਰੂ ਸ੍ਰੀ ਵਿੱਚ ਅੰਦਰ ਸਾਈਆਂ ਗਈਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਉਤਾਰਿਆ ਜਿਸ ਨਾਲ ਉਹਨਾਂ ਨੂੰ ਸਮਾਨਤਾ ਅਤੇ ਇੱਜ਼ਤ ਮਿਲੀ ਜੰਗ ਦੇ ਸਮੇਂ ਪਹਿਲੇ ਅਤੇ ਜੰਗ ਦੇ ਸਮੇਂ ਪਹਿਲੀ ਅਤੇ ਦੂਜੀ ਵਿਸ਼ਵ ਯੁੱਧ ਦੌਰਾਨ ਔਰਤਾਂ ਨੇ ਰਾਜਨੀਤਿਕ ਅਤੇ ਸਮਾਜਿਕ ਜੰਗਾਂ ਵਿੱਚ ਹਿੱਸਾ ਲਿਆ ਜੋ ਸਮਾਜ ਦੇ ਤੰਦਰੁਸਤ ਕਰਨ ਵਿੱਚ ਮਦਦ ਕਰਨ ਵਿੱਚ ਮਦਦਗਾਰ ਸਾਬਿਤ ਹੋਇਆ ਸਮਕਾਲੀ ਸਮੇਂ ਵਿੱਚ ਔਰਤਾਂ ਦੀ ਭੂਮਿਕਾ ਸਿੱਖਿਆ ਆਜ਼ਾਦੀ ਨੇ ਆਜ਼ਾਦੀ ਦੇ ਬਾਅਦ ਪੰਜਾਬ ਵਿੱਚ ਔਰਤਾਂ ਦੀ ਸਿੱਖਿਆ ਦੀ ਦਰ ਵਧੀ ਔਰਤਾਂ ਨੇ ਵਿਦਿਆਰਥੀਆਂ ਦੇ ਤੌਰ ਤੇ ਅੱਗੇ ਆ ਕੇ ਉਹਨਾਂ ਨੂੰ ਦੇ ਹੱਕਾਂ ਦੀ ਲੜਾਈ ਲੜੀ ਅਤੇ ਅਤੇ ਮਹਿਲਾਵਾਂ ਨੇ ਖੇਤੀਬਾੜੀ ਹਤਕਲਾ ਅਤੇ ਘਰੇਲੂ ਉਦਯੋਗਾਂ ਵਿੱਚ ਭਾਗ ਲੈ ਕੇ ਆਰਥਿਕ ਵਿਕਾਸ ਵਿੱਚ ਯੋਗਦਾਨ ਦਿੱਤਾ ਮਹਿਲਾ ਸਾਹਿਤ ਅਤੇ ਕਾਰੋਬਾਰਾਂ ਸਾਹਿਤ ਅਤੇ ਕਾਰੋਬਾਰਾਂ ਨੂੰ ਵੀ ਬਹੁਤ ਸਹਾਰਾ ਮਿਲਿਆ ਰਾਜਨੀਤਿਕ ਭਾਕੀਦਾਰੀ ਔਰਤਾਂ ਨੇ ਰਾਜਨੀਤਿਕ ਮੰਚਾਂ ਅਤੇ ਆਪਣੀ ਆਵਾਜ਼ ਨੂੰ ਮਜਬੂਤ ਕੀਤਾ ਜਿਸ ਨਾਲ ਉਹ ਪ੍ਰਸ਼ਾਸਨਿਕ ਅਤੇ ਨੀਤੀ ਗਰੁੱਪਾਂ ਵਿੱਚ ਸ਼ਾਮਿਲ ਹੋਈਆਂ ਸਮਾਜਿਕ ਸੁਧਾਰ ਔਰਤਾਂ ਸਮਾਜਿਕ ਸੁਧਾਰ ਔਰਤਾਂ ਦੀ ਸਮਾਜਿਕ ਸੁਧਾਰਾਂ ਵਿੱਚ ਅਹਿਮ ਭੂਮਿਕਾ ਨਿਭਾਈ ਜਿਵੇਂ ਕਿ ਬੱਚੀਆਂ ਦੀ ਸਿੱਖਿਆ ਸਿੱਖਿਆ ਬਲਾਤਕਾਰ ਅਤੇ ਵਿਆਹ ਸਬੰਧੀ ਸਮੱਸਿਆਵਾਂ ਦੇ ਖਿਲਾਫ ਲੜਾਈ ਲੜੀ ਲਾਮ ਅਤੇ ਚੁਣੌਤੀਆਂ ਲਾਭ ਔਰ ਖਿਡਾਰੀ ਨੇ ਔਰਤਾਂ ਦੀ ਭਾਗੀਦਾਰੀ ਨੇ ਸਮਾਜ ਦੇ ਵਿਕਾਸ ਅਤੇ ਸਿੱਖਿਆ ਤੇ ਆਰਥਿਕ ਮਕੈਨਿ ਮਜਬੂਤ ਕੀਤਾ ਜਿਸ ਨਾਲ ਔਰਤਾਂ ਨੂੰ ਸਮਾਨਤਾ ਸਿਹਤ ਅਤੇ ਸੁਰੱਖਿਆ ਦੇ ਹੱਕ ਪ੍ਰਦਾਨ ਕੀਤੇ ਚੁਣੌਤੀਆਂ ਹਾਲਾਂਕਿ ਚੁਣੌਤੀਆਂ ਹਾਲਾਂਕਿ ਔਰਤਾਂ ਨੇ ਅਨੇਕ ਅਗਵਾਈ ਕੀਤੀ ਪਰ ਉਹਨਾਂ ਨੂੰ ਅਜੇ ਵੀ ਅਨੇਕ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸਾਹਮਣਾ ਕਰਨਾ ਪਿਆ ਹੈ ਜਿਵੇਂ ਕਿ ਘਰੇਲੂ ਹਿੰਸਾ ਲਿੰਗ ਅਸਮਾਨਤਾਵਾਂ ਅਤੇ ਮੂਲ ਧਰਾਵਾਂ ਦੀ ਘਾਟ